ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਬਹੁਤ ਸਾਰੀ ਜਗ੍ਹਾ ਹਨ ਜਿਹੜੀਆਂ ਕੁਝ ਇੱਦਾਂ ਦੀ ਜਗ੍ਹਾ ਵੀ ਹਨ ਜਿਹੜੇ ਸੈਲਾਨੀਆਂ ਨੂੰ ਪਤਾ ਨਹੀਂ ਹੈ ਪਰ ਉਹ ਉੱਥੇ ਘੁੰਮਣ ਵੀ ਜਾ ਸਕਦੇ ਹਨ ਜਿੱਦਾਂ ਕਿ ਨੂਰਪੁਰ ਕਿਲ੍ਹਾ ਇਹ ਕਿਲ੍ਹਾ ਪਠਾਨਕੋਟ ਦੇ ਨੇੜੇ ਸਥਿਤ ਹੈ ਅਤੇ ਇਸ ਦਾ ਨਿਰਮਾਣ ਸੌਲਵੀਂ ਸਦੀ ਵਿੱਚ ਹੋਇਆ ਸੀ ਇਹ ਕਿਲ੍ਹਾ ਆਪਣੇ ਇਤਿਹਾਸ ਅਤੇ ਸੁੰਦਰ ਵਸਤੂ ਕਲਾ ਲਈ ਮਸ਼ਹੂਰ ਹੈ ਦੂਸਰਾ ਸ਼ਾਹਪੁਰ ਪੁਰਖੜ ਕੰਡੀ ਫੋਟ ਇਹ ਕਿਲ੍ਹਾ ਰਾਵੀ ਨਦੀ ਦੇ ਕੰਢੇ 'ਤੇ ਸਥਿਤ ਹੈ ਅਤੇ ਇਹ ਆਪਣੀ ਸੁੰਦਰਤਾ ਅਤੇ ਇਤਿਹਾਸਿਕ ਮਹੱਤਵ ਲਈ ਜਾਣਿਆ ਜਾਂਦਾ ਹੈ ਤੀਸਰਾ ਮੁਗਲ ਸਰਾਏ

ਸਰਾ ਸਰਾ ਸਹਾ ਸਰਾਏ ਲੁਧਿਆਣੇ ਦੇ ਨੇੜੇ ਸਥਿੱਤ ਹੈ ਅਤੇ ਮੁਗਲ ਕਾਲ ਦੌਰਾਨ ਯਾਤਰੀਆਂ ਅਤੇ ਵਪਾਰੀਆਂ ਲਈ ਆਰਾਮ ਦੀ ਜਗ੍ਹਾ ਦੇ ਤੌਰ 'ਤੇ ਬਣਾਇਆ ਗਿਆ ਸੀ ਇਸਨੇ ਇਤਿਹਾਸ ਦੇ ਅਨੇਕਾਂ ਮਹੱਤਵਪੂਰਨ ਪੜਾਅ ਦੇਖੇ ਹਨ ਅਤੇ ਅਜੇ ਵੀ ਇਹ ਆਪਣੀ ਪੁਰਾਣੀ ਵਸਤੂ ਕਲਾ ਅਤੇ ਇਤਿਹਾਸਿਕ ਮਹੱਤਵ ਲਈ ਯਾਦ ਕੀਤਾ ਜਾਂਦਾ ਹੈ ਹੋਰ ਵੀ ਕਈ ਸੁੰਦਰ ਅਤੇ ਇਤਿਹਾਸਿਕ ਸਥਾਨ ਹਨ ਜੋ ਪੰਜਾਬ ਵਿੱਚ ਸੈਲਾਨੀਆਂ ਲਈ ਘੁੰਮਣ ਦੇ ਸਥਾਨ ਦੇ ਰੂਪ ਵਿੱਚ ਮਸ਼ਹੂਰ ਹਨ ਹੋਰ ਜਿੱਦਾਂ ਕਿ ਪਹਿਲਾਂ ਕਿਲ੍ਹਾ ਗੋਬਿੰਦਗੜ ਅੰਮ੍ਰਿਤਸਰ ਵਿੱਚ ਸਥਿਤ ਹੈ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਣਾਇਆ ਗਿਆ ਸੀ ਅਤੇ ਇਸ ਦੀ ਵਸਤੂ ਕਲਾ ਅਤੇ ਇਤਿਹਾਸਿਕ ਨੂੰ ਦੇਖਣ ਲਈ ਲੋਕ ਆਉਂਦੇ ਹਨ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹਨ ਜਿੱਦਾਂ ਜਿਹੜੀਆਂ ਕਿ ਸੈਲਾਨੀਆਂ ਨੂੰ ਨਹੀਂ ਪਤਾ ਹੈ ਜਿੱਦਾ ਕੀ ਜਲ੍ਹਿਆਂਵਾਲਾ ਬਾਗ ਧੰਨਵਾਦ ਜੀ